ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਪ੍ਰੰਪਰਾਗਤ ਖੇਡਾਂ ਹਨ ਜਿਵੇਂ ਕਿ ਕਬੱਡੀ ਅਤੇ ਕੁਸ਼ਤੀ ਕਬੱਡੀ ਇੱਕ ਜ਼ੋਰ ਦੀ ਖੇਡ ਹੈ ਸਾਡੇ ਪੰਜਾਬ ਦੇ ਵਿੱਚ ਇੱਕ ਬਹੁਤ ਦੂਰੋਂ ਦੂਰੋਂ ਕਬੱਡੀ ਦੇਖਣ ਆਉਂਦੇ ਹਨ ਅਤੇ ਕੁਸ਼ਤੀ ਦੇਖਣ ਆਉਂਦੇ ਹਨ ਸਾਡੇ ਪੰਜਾਬ ਦੇ ਵਿੱਚ ਛਿੰਝ ਮੇਲੇ ਹੁੰਦੇ ਹਨ ਜਿਵੇਂ ਕਿ ਪਿੰਡਾਂ ਦੇ ਵਿੱਚ ਮੇਲਾ ਹੁੰਦਾ ਹੈ ਮਾੜੀ 'ਤੇ 'ਤੇ ਛਿੰਝ ਕਰਵਾਈ ਜਾਂਦੀ ਹੈ ਉਨ੍ਹਾਂ ਦੇ ਵਿੱਚ ਦੋ ਭਲਵਾਨ ਘੁਲਦੇ ਹਨ ਤੇ ਉਨ੍ਹਾਂ ਨੂੰ ਝੰਡੀ ਦੀ ਕੁਸ਼ਤੀ ਵਿੱਚ ਬਹੁਤ ਸਾਰੇ ਇਨਾਮ ਦਿੱਤੇ ਜਾਂਦੇ ਹਨ ਜਿਵੇਂ ਕਿ ਪਹਿਲਾਂ ਇਨਾਮ ਟਰੈਕਟਰ ਅਤੇ ਕਬੱਡੀ ਦੇ ਵਿੱਚ ਬੈਸਟਾ ਨੂੰ ਬੈਸਟ ਜਾਫੀ ਅਤੇ ਰੇਡਰ ਨੂੰ ਬੁਲਟ ਮੋਟਰਸਾਈਕਲ ਕਾਰਾਂ ਆਦਿ ਦਿੱਤੀਆਂ ਜਾਂਦੀਆਂ ਹਨ ਜੋੇ ਖੇਡ ਕਬੱਡੀ ਅਤੇ ਕੁਸ਼ਤੀ ਸਾਡੇ ਛੇਵੇਂ ਪਾਤਸ਼ਾਹੀ ਸ਼੍ਰੀ ਹਰਗੋਬਿੰਦ ਸਿੰਘ ਜੀ ਦੀ ਬਖਸ਼ੀ ਹੋਈ ਖੇਡ ਹੈ